ਹਾਂਜੀ ਸਾਡੇ ਪੰਜਾਬ ਦੇ ਵਿੱਚ ਅੰਮ੍ਰਿਤਸਰ 'ਚ ਖਾਸ ਕਰਕੇ ਟੂਰਿਸਟ ਜਿਸ ਵੇਲੇ ਬਾਹਰੋਂ ਆਉਣਗੇ ਤਾਂ ਉਹਨਾਂ ਵਾਸਤੇ ਕਾਫ਼ੀ ਇੱਥੇ ਵਿਲੱਖਣ ਰਿਹਾਇਸ਼ਾਂ ਹੈਗੀਆਂ ਹੋਮ ਸਟੇਅ ਤਾਂ ਨਹੀ ਹੁਣ ਹੈਗੇ ਜਿਹੜੇ ਵੀ ਸੈਲਾਨੀ ਪੰਜਾਬ ਤਾਂ ਆਉਣਗੇ ਉਹਨਾਂ ਨੂੰ ਕੋਈ ਠਹਿਰਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੇ ਜਗ੍ਹਾ ਜਗ੍ਹਾ 'ਤੇ ਸਰਾਂਵਾਂ ਅਤੇ ਹੋਟਲ ਬਹੁਤ ਜ਼ਿਆਦਾ ਖੁੱਲ੍ਹੇ ਹੈਗੇ ਆ ਅੰਮ੍ਰਿਤਸਰ ਨੂੰ ਕਦੇ ਹੁਣ ਹੋਟਲਾਂ ਦੀ ਨਗਰੀ ਉਹ ਕਿਹਾ ਜਾਏਗਾ ਕਦੇ ਨਾ ਕਦੇ ਕਿਉਂਕਿ ਇੱਥੇ ਚੱਪੇ ਚੱਪੇ 'ਤੇ ਹੁਣ ਹੋਟਲ ਖੁੱਲ੍ਹ ਚੁੱਕੇ ਆ ਸਰਾਂ ਖੁੱਲ੍ਹ ਚੁੱਕੇ ਜਿਹੜੇ ਕਿ ਲੰਗਰ ਵੀ ਦਿੰਦੇ ਆ ਅਤੇ ਨਾਲ਼ ਫ੍ਰੀ ਕੋਸਟ ਵੀ ਦਿੰਦੇ ਆ ਹੋਟਲ ਤਾਂ ਚਲੋ ਨਹੀਂ ਫ੍ਰੀ ਕੋਸਟ ਹੈਗੇ ਪਰ ਹੁਣ ਕਾਫ਼ੀ ਇੱਥੇ ਹੋਟਲ ਜ਼ਿਆਦਾ ਖੁੱਲ੍ਹ ਗਏ ਨੇ ਜਿਹੜੇ ਕਿ ਅਸੀਂ ਅੱਜ ਤੋਂ ਪੰਜੀ ਸਾਲ ਪਹਿਲਾਂ ਦੇਖਦੇ ਸੀ ਕਿਤੇ ਹੋਣਗੇ ਵੀਹ ਪੱਚੀ ਹੁਣ ਇੱਥੇ ਚਾਰ ਸੌ ਦੇ ਕਰੀਬ ਹੋਟਲ ਖੁੱਲ੍ਹ ਚੁੱਕੇ ਹੋਏ ਆ ਔਰ ਇਸ ਵੇਲੇ ਬਾਹਰ ਬਾਹਰੋਂ ਜੇ ਕੋਈ ਆਉਂਦਾ ਵੈ ਤਾਂ ਉਹਨੂੰ ਕੋਈ ਠਹਿਰਣ ਦੀ ਕੋਈ ਮੁਸ਼ਕਿਲ ਨਹੀਂ ਹੁੰਦੀ ਜੇ ਉਹ ਚਾਹਵੇ ਤਾਂ ਜ਼ਿਆਦਾ ਪ੍ਰਾਈਜ 'ਤੇ ਵੀ ਖਰਚ ਕੇ ਹੋਟਲ ਲੈ ਸਕਦਾ ਘੱਟ ਪ੍ਰਾਈਜ 'ਤੇ ਵੀ ਮਿਲ ਜਾਏਗਾ ਹਰ ਇਨਸਾਨ ਨੂੰ ਮਿਲ ਸਕਦਾ ਹੁਣ ਉਹ ਕਿਸੇ ਆਪਣੇ ਰਿਸ਼ਤੇਦਾਰ ਕੋਲ ਠਹਿਰਣਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਅਗਲਾ ਕਹਿੰਦਾ ਵਾ ਕਿ ਅਗਲੇ ਨੂੰ ਵੀ ਤੰਗ ਕਰਨਾ ਅਤੇ ਆਪਣੇ ਆਪ ਨੂੰ ਵੀ ਤੰਗ ਕਰਨਾ ਅੱਜ ਕੱਲ੍ਹ ਲੋਕ ਇੰਨੇ ਕੁ ਜ਼ਿਆਦਾ ਇਕੱਲੇ ਰਹਿਣਾ ਪਸੰਦ ਕਰਦੇ ਆਪਣੇ ਆਪ ਨੂੰ ਕਿ ਦੂਸਰੇ ਨੂੰ ਅਸੀਂ ਤਕਲੀਫ਼ ਨਹੀਂ ਦੇਣੀ ਅਤੇ ਹੁਣ ਹੋਮ ਸਟੇਅ ਦਾ ਤਾਂ ਬਿਲਕੁਲ ਹੀ ਉੱਡਦਾ ਹੀ ਪਿਆ ਰਿਵਾਜ਼ ਤਾਂ ਹੋ ਹੋਟਲ ਜਿਹੜੀ ਕਲਚਰ ਹੈਗੀ ਆ ਉਹ ਆ ਰਹੀ ਹੈ ਕਿ ਜੇ ਇੱਥੇ ਆਪਣੇ ਰਿਸ਼ਤੇਦਾਰ ਵੀ ਹੋਣ ਅਤੇ ਉਹ ਨਹੀਂ ਉੱਥੇ ਰਹਿਣਾ ਪਸੰਦ ਕਰਦੇ ਉਹਨਾਂ ਨੂੰ ਹੈਗਾ ਕਿ ਚਲੋ ਅਸੀਂ ਉੱਥੇ ਜੇ ਪੈਸੇ ਖਰਚ ਸਕਦੇ ਹਾਂ ਅਤੇ ਅਸੀਂ ਹੋਟਲ 'ਚ ਜਾ ਕੇ ਠਹਿਰੀਏ ਕਿਉਂ ਦੂਸਰਿਆਂ ਨੂੰ ਤੰਗ ਕਰਨਾ ਔਰ ਇੱਥੇ ਪੰਜਾਬ 'ਚ ਹੁਣ ਅੰਮ੍ਰਿਤਸਰ 'ਚ ਖਾਸ ਕਰਕੇ ਜਿਹੜਾ ਦਰਬਾਰ ਸਾਹਿਬ ਦੇ ਕਰਕੇ ਕਾਫ਼ੀ ਹੋਟਲ ਖੁੱਲ੍ਹ ਗਏ ਨੇ ਅਤੇ ਕਾਫ਼ੀ ਲੋਕ ਇੱਥੇ ਆਉਂਦੇ ਹੈ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਕਿ ਅਸੀਂ ਠਹਿਰਨਾ ਕਿੱਥੇ ਠਹਿਰਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ